ਈ ਬੁੱਕਸ ਦੇ ਬਾਰੇ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਇਹ ਹੈ ਵੀ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਕਿਤਾਬਾਂ ਸਨ ਉਹ ਨਹੀਂ ਮਿਲਦੀਆਂ ਸਨ ਅਤੇ ਅੱਜ ਦਾ ਜਿਹੜਾ ਸਮਾਂ ਹੈ ਅੱਜ ਦਾ ਜਿਹੜਾ ਯੁੱਗ ਹੈ ਬਹੁਤ ਅੱਗੇ ਨਿਕਲ ਚੁੱਕਿਆ ਅਤੇ ਪਿੱਛੇ ਜਿਹੇ ਮੈਂ ਈ ਬੁੱਕਸ ਦੇ ਬਾਰੇ ਅਕਸਰ ਸੁਣਦਾ ਰਹਿੰਦਾ ਹੁੰਦਾ ਸੀ ਪਰ ਜਦੋਂ ਕਦੋਂ ਮੈਨੂੰ ਇੱਕ ਬੁੱਕ ਸੀ ਬਹੁਤ ਪੁਰਾਣੀ ਉਹਦੀ ਜ਼ਰੂਰਤ ਪਈ ਉਹ ਨਹੀਂ ਮਿਲੀ ਆਮ ਅਤੇ ਮੈਂ ਈ ਬੁੱਕਸ ਦੇ ਔਨਲਾਈਨ ਜਾ ਕੇ ਉਸ ਦੀ ਖੋਜ ਕੀਤੀ ਅਤੇ ਉਹ ਬੜੀ ਜਲਦੀ ਅਤੇ ਬੜੀ ਆਸਾਨੀ ਦੇ ਨਾਲ ਮਿਲ ਗਈ ਅਤੇ ਉਸ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆਈ ਉਸਨੂੰ ਪੜ੍ਹ ਕੇ ਅਤੇ ਮੈਂ ਹੁਣ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਹੜਾ ਈ ਬੁੱਕਸ ਦਾ ਰੁਝਾਨ ਹੈ ਉਹ ਬਹੁਤ ਵਧੀਆ ਹੈ ਅਤੇ ਹਰ ਇੱਕ ਇਨਸਾਨ ਕਿਤੇ ਵੀ ਨਾ ਜਾ ਕੇ ਆਪਣੇ ਫੋਨ ਦੇ ਉੱਤੇ ਇਸ ਚੀਜ਼ ਨੂੰ ਪੜ੍ਹ ਸਕਦਾ ਹੈ